ਰਾਜ ਸਰਕਾਰ ਪੰਜਾਬ ਵਿੱਚ ਸਾਰੇ ਨਾਗਰਿਕਾਂ ਲਈ ਬਰਾਬਰ ਪ੍ਰਤੀਨਿਧਤਾ ਅਤੇ ਸੱਤਾ ਤੱਕ ਪਹੁੰਚ ਨੂੰ ਕਾਫ਼ੀ ਹੱਦ ਤੱਕ ਯਕੀਨੀ ਬਣਾਉਂਦੀ ਹੈ ਅਲੱਗ ਅਲੱਗ ਪਿੰਡਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਸਕੀਮਾਂ ਕਈ ਤਰ੍ਹਾਂ ਦੇ ਲੈਕਚਰ ਕਰਵਾਏ ਜਾਂਦੇ ਹਨ ਜਿਨਾਂ ਦੇ ਵਿੱਚ ਕੁੜੀਆਂ ਲਈ ਖ਼ਾਸ ਐਜੂਕੇਸ਼ਨ ਪੜ੍ਹਾਈ ਕਈ ਤਰ੍ਹਾਂ ਦੀਆਂ ਹੋਰ ਸਕੀਮਾਂ ਪਿੰਡ ਦੀ ਪੰਚਾਇਤ ਇਲੈਕਸ਼ਨ ਦੇ ਵਿੱਚ ਔਰਤਾਂ ਦੀ ਉਮੀਦਵਾਰ ਨੂੰ ਯਕੀਨੀ ਬਣਾਉਣਾ ਜਾਂ ਫਿਰ ਮਿਊਨਸੀਪਲਟੀ ਜਿਹੜੇ ਇਲੈਕਸ਼ਨ ਹੁੰਦੇ ਹਨ ਉਹਨਾਂ ਦੇ ਵਿੱਚ ਔਰਤਾਂ ਦੀ ਪ੍ਰਤੀਨਿਧਤਾ ਨੂੰ ਮਹੱਤਵਪੂਰਨ ਬਣਾਉਣਾ ਜਿੱਥੇ ਕਿ ਪਹਿਲੇ ਟਾਈਮ ਦੇ ਵਿੱਚ ਕੁੜੀਆਂ ਲਈ ਐਜੂਕੇਸ਼ਨ ਹੀ ਇੱਕ ਬਹੁਤ ਵੱਡਾ ਰਿਸਕ ਬਣ ਕੇ ਰਹਿ ਗਿਆ ਸੀਗਾ ਲੋਕਾਂ ਨੇ ਕੁੜੀਆਂ ਨੂੰ ਪੜ੍ਹਾਉਣਾ ਬੰਦ ਕਰ ਦਿੱਤਾ ਸੀ ਲੋਕ ਜ਼ਿਆਦਾਤਰ ਕੁੜੀ ਅਤੇ ਮੁੰਡੇ ਵਿੱਚ ਫਰਕ ਕਰਦੇ ਸੀ ਉੱਥੇ ਹੀ ਸਰਕਾਰ ਨੇ ਹੁਣ ਕੁੜੀਆਂ ਦੇ ਲਈ ਫਰੀ ਐਜੂਕੇਸ਼ਨ ਜਿਹੜੀਆਂ ਕੁੜੀਆਂ ਦੂਰ ਘਰਾਂ ਤੋਂ ਜਾ ਕੇ ਨਹੀਂ ਪੜ੍ਹ ਸਕਦੀਆਂ ਫਰੀ ਹੋਸਟਲ ਜਾਂ ਫਿਰ ਕਈ ਇੱਦਾਂ ਦੇ ਇੰਸਟੀਚਿਊਸ਼ਨ ਬਣਾਏ ਹਨ ਜਿੱਥੇ ਕਿ ਕੁੜੀਆਂ ਫਰੀ ਐਜੂਕੇਸ਼ਨ ਪ੍ਰਾਪਤ ਕਰ ਸਕਦੀਆਂ ਹਨ ਅੱਜ ਦੇ ਇਸ ਟੈਕਨੋਲੋਜੀ ਦੇ ਵ ਸਮੇਂ ਦੇ ਵਿੱਚ ਆਪਣੇ ਆਪ ਨੂੰ ਸਮਾਜ ਦੇ ਵਿੱਚ ਮਰਦ ਸਮਾਜ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਕਰਨ ਦੀ ਸ਼ਮਤਾ ਪ੍ਰਦਾਨ ਕਰਦੀ ਹੈ ਇਸ ਤਰੀਕੇ ਨਾਲ ਅੱਜ ਦਾ ਸਮਾਜ ਕੱਲ੍ਹ ਵਾਲੇ ਸਮਾਜ ਨੂੰ ਪੁਰਾਣੀ ਰੂੜੀਵਾਦੀ ਸੋਚ ਵਾਲੇ ਸਮਾਜ ਨੂੰ ਬਹੁਤ ਹੀ ਵੱਡੀ ਟੱਕਰ ਦਿੰਦਾ ਹੈ